ਹੈਲੋ ਹਾਂਜੀ ਹਾਂਜੀ ਅਸੀਂ ਅਬੋਰ ਰੋਡ ਤੋਂ ਗੋਲ ਚੱਕਰ ਤੋਂ ਬੋਲਦੇ ਪਏ ਆ ਹਾਂਜੀ ਚੱਕਰ ਤਾਂ ਹੁੰਦਾ ਓ ਹਾਂਜੀ ਰੱਸ਼ ਈ ਬਹੁਤ ਹੋ ਜਾਂਦਾ ਹੈਗਾ ਇਧਰੋਂ ਸਕੂਲਾਂ ਦੀ ਕਾਲਜਾਂ ਦੀ ਛੁੱਟੀ ਹੋ ਜਾਂਦੀ ਹੈ ਫਿਰ ਮਤਲਬ ਛੋਟੇ ਮਤਲਬ ਰੋਡ ਵੱਡੇ ਹੈਗੇ ਰੱਸ਼ ਵਾ ਵਾ ਹੋ ਜਾਂਦਾ ਫਿਰ ਹਾਂਜੀ ਰੱਸ਼ ਤਾਂ ਹੋ ਹੀ ਜਾਂਦਾ ਫਿਰ ਸ਼ਹਿਰ ਛੋਟਾ ਹੈਗਾ ਤਾਂ ਕਰਕੇ ਫਿਰ ਵਾਧੂ ਰੱਸ਼ ਹੋ ਜਾਂਦਾ ਛੋਟਾ ਜਿਹਾ ਸ਼ਹਿਰ ਹੈਗਾ ਤੇ ਟ੍ਰੈਫਿਕ ਓਨਾ ਸਾਰੇ ਪਾਸੇ ਹੀ ਹ ਇੱਕ ਪਾਸੇ ਨੀ ਸਾਰੇ ਪਾਸੇ ਭੀੜ ਟਰੈਫਿਕ ਨਾ ਹੁੰਦਾ ਨਾ ਬਹੁਤ ਜਿਆਦਾ ਇੱਕ ਪਾਸੇ ਵੀ ਐਵੇਂ ਨਹੀਂ ਗੋਲ ਚੱਕਰ ਤੇ ਇਧਰਲੇ ਪਾਸੇ ਘੰਟੇ ਘਰ ਵਾਲੇ ਪਾਸੇ ਵੀ ਵਾਧੂ ਮਤਲਵ ਟਰੈਫਿਕ ਹੁੰਦਾ ਤੇ ਅਬੋਰ ਰੋਡ ਤੇ ਵੀ ਵਾਧੂ ਟਰੈਫਿਕ ਹੁੰਦਾ ਇਧਰ ਆਜੋ ਸਟੇਸ਼ਨ ਵਾਲੇ ਪਾਸੇ ਕਿਹੜੇ ਪਾਸੇ ਸਾਰੇ ਪਾਸੇ ਰਸ਼ ਹੁੰਦਾ ਟ੍ਰੈਫਿਕ ਇੰਨਾ ਲੱਗਿਆ ਹੁੰਦਾ ਬਹੁਤ ਜਿਆਦਾ ਉਹੀ ਤਾਂ ਗੱਲ ਐ ਡਰਦੇ ਨੀ ਨਿਕਲਦੇ ਆ ਜੀ ਹਾਂ ਵੀ ਜਦ ਟਰੈਫਿਕ ਨਾ ਹੀ ਹੋਵੇ ਉਥੇ ਖੜਨਾ ਪੈਂਦਾ ਫਿਰ ਕਿੰਨੀ ਕਿੰਨੀ ਦੇਰ ਵਾਰੀ ਨਹੀਂ ਆਉਂਦੀ ਲੰਘਣ ਟੱਪਣ ਦੀ ਯਾਤਰੀ ਨੂੰ ਬਹੁਤ ਜਿਆਦਾ ਮੁਸ਼ਕਿਲ ਹੁੰਦੀ ਹੈਗੀ ਹੈ ਹੋਰ ਜੀ ਤੁਸੀਂ ਕਦੋਂ ਆਏ ਸੀ ਹਾਂਜੀ ਉਹ ਤੇ ਹਾਂ ਹਾਂਜੀ ਹਾਂ ਬਸ ਸਟੈਂਡ ਵੀ ਬਹੁਤ ਹੋਤਾ ਹੈ ਫਿਰ ਵੋ ਹੀ ਬਾਤ ਹੈ ਨਾ ਵੀ ਜਿੱਧਰ ਜਾਓ ਉੱਧਰ ਹੀ ਰੱਸ਼ ਬਹੁਤ ਹੋਤਾ ਹੈ ਟ੍ਰੈਫਿਕ ਕਾ ਅਬ ਐਕਸੀਡੈਂਟ ਵੀ ਕਿਤਨੇ ਹੋਤੇ ਹੈ ਬਹੁਤ ਜਿਆਦਾ ਐਕਸੀਡੈਂਟ ਹੋਤੇ ਹੈ ਇਸਕੀ ਵਜਾ ਸੇ ਵੀ ਟ੍ਰੈੈਫਿਕ ਕਿਤਨਾ ਲਗਾ ਹੋਤਾ ਹੈ ਵੀ ਬਹੁਤ ਜਿਆਦਾ ਟ੍ਰੈਫਿਕ ਲਗਾ ਹੋਤਾ ਹੈ ਅਬ ਲੰਘਨਾ ਟੱਪਣਾ ਮੁਸ਼ਕਿਲ ਹੋ ਜਾਤਾ ਹੈ ਹਾਂਜੀ ਅਬੀ ਤੋਂ ਛੇਤੀ ਥੀ ਟ੍ਰੈਫਿਕ ਲੈ ਕੇ ਐਕਟਿਵਾ ਵਗੈਰਾ ਮੋਟਰਸਾਈਕਲ ਵਗੈਰਾ ਲੈ ਕੇ ਨਿਕਲਤੇ ਨਹੀਂ ਔਰ ਨਿਕਲਤੇ ਹੈ ਤੋਂ ਕਿਤਨਾ ਟ੍ਰੈਫਿਕ ਹੋਤਾ ਹੈ ਆਗੇ ਜਾਏ ਤੋਂ

ਹਾਂਜੀ ਹਾਂਜੀ ਹਾਂ ਵੋਹੀ ਬਾਤ ਭੀੜ ਮੇ ਫਿਰ ਇਹ ਇਸ ਮਤਲਬ ਸਾਇਕਲ ਅੜ ਜਾਏ ਜਾਂ ਕੋਈ ਕੁਛ ਵੀ ਆਗੇ ਐਕਟਿਵਾ ਵਗੈਰਾ ਅੜ ਜਾਏ ਤੋ ਫਿਰ ਪੀਛੇ ਤੋਂ ਫਿਰ ਟ੍ਰੈਫਿਕ ਹੋਏਗਾ ਨਾ ਪੀੜ ਭੀੜ ਤਾਂ ਉਥੇ ਹੀ ਜਮਾਂ ਹੋ ਜਾਂਦੀ ਹੈਗੀ ਨਾ ਭੀੜ ਉੱਥੇ ਜਮਾਂ ਹੋ ਜਾਂਦੀ ਐ ਵੱਧ ਟਰੈਫਿਕ ਹੋ ਜਾਂਦਾ ਚਲੋ ਠੀਕ ਐ ਜੀ